ਹਾਂ ਮੈਂ ਬਹੁਤ ਵਾਰ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦਾ ਪ੍ਰਯੋਗ ਕੀਤਾ ਹੈ ਇਸ ਨਾਲ ਤੁਹਾਡੀ ਫੋਟੋ ਇੱਕ ਪੁਰਾਣੀ ਅਤੇ ਬਹੁਤ ਵਧੀਆ ਚਿੱਤਰ ਵਿੱਚ ਤਬਦੀਲ ਹੋ ਜਾਂਦੀ ਹੈ ਇਸ ਵਿੱਚ ਤੁਸੀਂ ਆਪਣੇ ਚਿੱਤਰ ਨੂੰ ਇੱਕ ਓਲਡ ਸਕੂਲ ਤਰੀਕੇ ਦੇ ਨਾਲ ਦੇਖ ਸਕਦੇ ਹੋ ਅਤੇ ਅਗਰ ਮੈਂ ਦੱਸਾਂ ਮੋਨੋਕਰਮੈਟਿਕ ਚਿੱਤਰਾਂ ਬਾਰੇ ਇਹ ਇੱਕ ਬਹੁਤ ਹੀ ਜ਼ਿਆਦਾ ਵਧੀਆ ਚਿੱਤਰ ਹੁੰਦੇ ਹਨ ਇਹਨਾਂ ਨੂੰ ਦੇਖ ਕੇ ਤੁਹਾਨੂੰ ਆਪਣੇ ਦਿਲ ਵਿੱਚ ਸਕੂਨ ਮਿਲਦਾ ਹੈ ਅਤੇ ਤੁਸੀਂ ਇਸ ਦਾ ਪ੍ਰਯੋਗ ਆਪਣੇ ਕੰਧ ਵਿੱਚ ਲਾਣ ਵਾਸਤੇ ਵੀ ਯੂਜ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡਾ ਦਿਲ ਬਹੁਤ ਖੁਸ਼ਹਾਲ ਹੋ ਜਾਏਗਾ ਅਤੇ ਜਦੋਂ ਤੁਸੀਂ ਇਹਨੂੰ ਦੇਖੋਗੇ ਅਤੇ ਤੁਹਾਨੂੰ ਲੱਗੇਗਾ ਕਿ ਇਹ ਤੁਸੀਂ ਹੀ ਹੋ